ਭੰਗੜੇ ਦੇ ਕੁਝ ਸਟੈਪ ਨ ਝੂਮਰ ਧਮਾਲ ਚਾਲ ਲੁੱਡੀ ਦਮ ਲੁੱਡੀ ਅਤੇ ਇਨ੍ਹਾਂ ਸਟੈਪ ਤੋਂ ਹੀ ਸਾਰੇ ਪੰਜਾਬੀ ਸੱਭਿਆਚਾਰ ਵਿੱਚ ਜ਼ੋਰਦਾਰ ਜਸ਼ਨ ਮਨਾਇਆ ਜਾਂਦਾ ਹੈ ਲੋਕਾਂ ਵਿੱਚ ਇਹਨਾਂ ਦੇ ਸੁਭਾਅ ਵਿੱਚ ਯੋਗਦਾਨ ਕਿਵੇਂ ਪਾਉਂਦੇ ਹਨ ਕੋਈ ਵੀ ਇਹਨਾ ਬਿਨਾਂ ਰਹਿ ਨਹੀਂ ਸਕਦਾ ਭੰਗੜੇ ਨੂੰ ਵੇਖ ਕੇ ਭੰਗੜੇ ਦੇ ਸਟੈਪ ਇੱਕ ਨੂੰ ਵੇਖ ਕੇ ਦੂਜੇ ਜਾਣੇ ਨੂੰ ਸਾਰੇ ਆਪਣੇ ਆਪ ਹੀ ਨੱਚਣ ਲੱਗ ਜਾਂਦੇ ਹਨ ਭੰਗੜਾ ਇੱਕ ਅਜਿਹੀ ਹੈ ਇਹ ਦੀ ਇੱਕ ਭਣਕ ਹੀ ਇਹ ਜਿਹੀ ਹੈ ਕਿ ਕੋਈ ਨੱਚਦਾ ਹੋਵੇ ਤਾਂ ਸਾਰੇ ਆਪਣੇ ਆਪ ਹੀ ਇੱਕ ਸਟੈਪ ਵੇਖ ਕੇ ਚਾਰ ਹੋਰ ਆਪਣੇ ਆਪ ਕਰਨ ਲੱਗ ਜਾਂਦੇ ਹਨ ਅਤੇ ਪੰਜਾਬੀ ਸੱਭਿਆਚਾਰ ਵਿੱਚ ਇਹਦਾ ਜਿਹੜਾ ਜਸ਼ਨ ਹੀ ਇਹਦਾ ਸੁਭਾਅ ਹੈ ਲੋਕਾਂ ਨੂੰ ਬਹੁਤ ਹੀ ਵਧੀਆ ਲੱਗਦਾ ਹੈ ਅਤੇ ਲੋਕ ਆਪ ਬਹੁਤ ਹੀ ਨੱਚਦੇ ਹਨ ਅਤੇ ਹਰੇਕ ਫੰਕਸ਼ਨ 'ਤੇ ਕਿਧਰੇ ਵੀ ਕੁਛ ਵੀ ਹੋਵੇ ਭਾਵੇਂ ਕੋਈ ਵਿਆਹ ਸ਼ਾਦੀ ਹੈ ਕੋਈ ਕਿਸੇ ਦੀ ਬਰਡੇ ਪਾਰਟੀ ਹੈ ਕਿਸੇ ਦੇ ਘਰ ਕੋਈ ਫੰਕਸ਼ਨ ਹੈ ਤਾਂ ਸਾਰੇ ਭੰਗੜਾ ਆਪਣੇ ਆਪ ਹੀ ਡਾਲਨ ਲੱਗ ਜਾਂਦੇ ਹਨ ਇਹਦੇ ਜਸ਼ਨ ਵਿੱਚ ਸਾਰੇ ਲੋਕ ਕੋਈ ਨਾ ਵੀ ਨੱਚਦਾ ਹੋਵੇ ਭੰਗੜਾ ਕਰਦੇ ਲੋਕਾਂ ਨੂੰ ਵੇਖ ਕੇ ਸਾਰੇ ਨੱਚਣ ਲੱਗ ਜਾਂਦੇ ਹਨ ਅਸੀਂ ਵੀ ਖੁਦ ਭੰਗੜਾ ਵੇਖਦਿਆਂ ਹੀ ਸਾਰੇ ਇੱਕ ਦੂਜੇ ਨੂੰ ਵੇਖ ਕੇ ਹੀ ਭੰਗੜੇ ਪਾਉਣ ਲੱਗ ਜਾਂਦੇ ਹਾਂ ਪੰਜਾਬੀ ਸੱਭਿਆਚਾਰ ਦੇ ਵਿੱਚ ਇਸ ਦਾ ਬਹੁਤ ਹੀ ਜਸ਼ਨ ਅਤੇ ਯੋਗਦਾਨ ਪਾਉਣ ਵਿੱਚ ਲੋਕਾਂ ਦਾ ਬਹੁਤ ਹੀ ਮਹੱਤਵ ਹੈ